ਦੌੜਨ ਲਈ ਸਾਨੂੰ ਸਭ ਤੋਂ ਜ਼ਿਆਦਾ ਸਭ ਤੋਂ ਪਹਿਲਾਂ ਜ਼ਰੂਰਤ ਹੈ ਸਪੋਰਟਸ ਕਿੱਟ ਦੀ ਅਤੇ ਗਰਾਊਂਡ ਦੀ ਕਿਉਂਕਿ ਅਸੀਂ ਸੜਕ 'ਤੇ ਜਾਂ ਕਿਤੇ ਹੋਰ ਪਾਸੇ ਦੌੜ ਨਹੀਂ ਕਰ ਸਕਦੇ ਹਨ ਉਸ ਨਾਲ ਸਾਨੂੰ ਸਾਡੀ ਸਿਹਤ 'ਤੇ ਨੁਕਸਾਨ ਦੇ ਚਾਂਸ ਵੱਧ ਜਾਂਦੇ ਹਨ ਜਿਨੂੰ ਅੰਗਰੇਜ਼ੀ ਵਿੱਚ ਇੰਜਰੀ ਕਹਿੰਦੇ ਹਨ ਉਸ ਦੇ ਚਾਂਸ ਵੱਧ ਜਾਂਦੇ ਹਨ ਉਸ ਲਈ ਸਾਨੂੰ ਸਭ ਤੋਂ ਪਹਿਲਾਂ ਗਰਾਊਂਡ ਦੀ ਜ਼ਰੂਰਤ ਹੈ ਅਤੇ ਗਰਮੀਆਂ ਵਿੱਚ ਦੌੜਨ ਲਈ ਸਾਨੂੰ ਨਿੱਕਰ ਸਪੋਰਟਸ ਸ਼ੂਜ਼ ਅਤੇ ਟੀ ਸ਼ਰਟ ਚਾਹੀਦਾ ਹੈ ਅਤੇ ਠੰਡ ਵਿੱਚ ਦੌੜਨ ਲਈ ਸਾਨੂੰ ਟਰੈਕਸੂਟ ਅਤੇ ਸਾਡੇ ਸ਼ੂਜ਼ ਚਾਹੀਦੇ ਹਨ ਅਤੇ ਬਰਸਾਤ ਵਿੱਚ ਸਾਨੂੰ ਦੌੜਨਾ ਨਹੀਂ ਚਾਹੀਦਾ ਕਿਉਂਕਿ ਇਸ ਦੇ ਨਾਲ ਸਾਨੂੰ ਸਾਡੀ ਇੰਜਰੀ ਦੇ ਚਾਂਸ ਵੱਧ ਜਾਂਦੇ ਹਨ